ਹਾਂਜੀ ਅਸੀਂ ਮੈਂ ਬਹੁਤ ਹੀ ਬਹੁਤ ਹੀ ਨਵੀਤਕਾਰੀ ਅਤੇ ਸ਼ਾਨਦਾਰ ਗੇਮਾਂ ਖੇਡੀਆਂ ਹਨ ਜਿਵੇਂ ਕਿ ਪਬਜੀ ਇਹ ਅੱਜ ਅੱਜ ਤੱਕ ਦੀ ਸਭ ਤੋਂ ਵਧੀਆ ਅਤੇ ਸ਼ਾਨਦਾਰ ਗੇਮ ਹੈ ਕਿਉਂਕਿ ਇਸ ਦੇ ਵਿਜ਼ੂਅਲਜ਼ ਅਤੇ ਗਰਾਫਿਕਸ ਬਹੁਤ ਹੀ ਜ਼ਬਰਦਸਤ ਹਨ ਇਹਦਾ ਇਹਦਾ ਆਡੀਓ ਵੀ ਬਹੁਤ ਹੀ ਬ ਵਧੀਆ ਹੈ ਅਤੇ ਸ਼ਾਨਦਾਰ ਹੈ ਇਹ ਗੇਮ ਅਸੀਂ ਤਾਂ ਖੇਡੀ ਸੀ ਤੋਂ ਕੀ ਇਹ ਉਸ ਟਾਈਮ ਦੀ ਸਭ ਤੋਂ ਫੇਮਸ ਅਤੇ ਰੁਚੀਦਾਰ ਗੇਮ ਮੰਨੀ ਗਈ ਸੀ ਇਹ ਗੇਮ ਨੂੰ ਦੇਖ ਕੇ ਸਾਰੇ ਨੌਜਵਾਨ ਇਸ ਵੱਲ ਅਕਰਸ਼ਿਤ ਵੀ ਹੋ ਰਹੇ ਸੀ ਅਸੀਂ ਉਸ ਲੋਕਡਾਊਨ ਦੇ ਦੌਰਾਨ ਯਕੀਨ ਖੇਡੀ ਹੈ ਜਦੋਂ ਅਸੀਂ ਫਰੀ ਹੁੰਦੇ ਸੀ ਅਤੇ ਸਾਡੇ ਕੋਲ ਕਰਨ ਦੀ ਕੋਈ ਕੰਮ ਨਹੀਂ ਸੀ ਅਸੀਂ ਘਰ ਦੇ ਚਾਰ ਮੈਂਬਰ ਇ ਇਕੱਠੇ ਬੈਠ ਕੇ ਇਸ ਦਾ ਆਨੰਦ ਲੈਣਦੇ ਸਨ ਇਹ ਗੇਮ ਬਹੁਤ ਹੀ ਵਧੀਆ ਤਰੀਕੇ ਅਤੇ ਲੰਬੇ ਸਮੇਂ ਤੱਕ ਕੇ ਲੰਬੇ ਸਮੇਂ ਤੱਕ ਖੇਡ ਸਕਦੇ ਹਨ ਇਹ ਗੇਮ ਉਸ ਟਾਈਮ ਦੀ ਸਭ ਤੋਂ ਫੇਮਸ ਅਤੇ ਉੱਚੀ ਦਾਰੀ ਗੇਮ ਮੰਨੀ ਗਈ ਸੀ ਕਿਉਂਕਿ ਇਸ ਇਸ ਗੇਮ ਦੇ ਇੱਕ ਮਹੀਨੇ ਵਿੱਚ ਹੀ ਦਸ ਲੱਖ ਡਾਊਨਲੋਡਜ਼ ਹੋ ਗਏ ਸਨ ਜੋ ਕਿ ਬਹੁਤ ਹੀ ਵੱਡੀ ਪ੍ਰਸਿੱਧੀ ਮੰਨੀ ਜਾਂਦੀ ਹੈ ਇਹ ਗੇਮ ਦਿਲ ਨੂੰ ਛੂਹੰਦੀ ਹੈ ਅਤੇ ਟਾਈਮ ਵੀ ਬਹੁਤ ਵਧੀਆ ਪਾਸ ਹੁੰਦਾ ਹੈ ਇਹ ਗੇਮ ਉਹ ਬੰਦਾ ਹੀ ਖੇਡ ਸਕਦਾ ਹੈ ਜੋ ਤਿੰਨ ਵਿੱਚ ਦੋ ਘੰਟੇ ਨਿਕਾਲ ਸਕਦਾ ਹੈ ਅਤੇ ਇਸ ਨੂੰ ਸਿੱਖਣ ਲਈ ਸਾਨੂੰ ਬਹੁਤ ਹੀ ਤਰੀਕੇ ਨਾਲ ਚੱਲ ਚੱਲਣਾ ਪੈਂਦਾ ਹੈ ਇਸ ਵਿੱਚ ਚਾਰ ਬੰਦੇ ਦੀ ਇੱਕ ਟੀਮ ਬਣਦੀ ਹੈ ਜੋ ਕਿ ਸ਼ਾਮੇ ਬੰਦਿਆਂ ਨਾਲ ਲੜ ਕੇ ਜਿੱਤ ਹਾਸਿਲ ਕਰਦੀ ਹੈ ਇਸ ਇਸ ਗੇਮ ਵਿੱਚ ਵੱਖ ਵੱਖ ਤਰਾਂ ਦੇ ਵੈਪਨ ਜਿਵੇਂ ਕਿ ਬੰਦੂਕ ਬੰਬ ਦੀ ਝਾਜਾਂ ਨੂੰ ਦਰਸ਼ਾਇਆ ਗਿਆ ਹੈ ਅਤੇ ਕਾਰਾਂ ਦੀ ਚੀਵੀ ਦਿਸੀ ਗਈ ਹੈ ਇਹ ਨੌਜਵਾਨਾਂ ਵਿੱਚ ਇੰਨੀ ਕੁ ਪ੍ਰਸਿੱਧ ਹੈ ਕਿ ਇਹ ਲੋਕ ਇਹਨਾਂ ਦਾ ਗੇਮਾਂ ਉਤੇ ਪੈਸੇ ਵੀ ਲਾਉਂਦੇ ਹਨ ਅਤੇ ਨਵੇਂ ਨਵੇਂ ਤਰ੍ਹਾਂ ਦੇ ਖੋਜ ਖੋਜ ਕਰਦੇ ਹਨ ਇਸ ਗੇਮ ਲਈ ਸਾਨੂੰ ਪਲੇ ਸਟੋਰ ਤੋਂ ਡਾਊਨਲੋਡ ਮਿਲ ਜਾਏਗੀ ਅਤੇ ਇਹ ਗੇਮ ਸਿਰਫ ਉਹੀ ਖੇਡ ਸਕਦੇ ਹਨ ਜਿੰਨਾਂ ਕੋਲ ਵਧੀਆ ਫੋਨ ਹਨ ਨਹੀਂ ਤਾਂ ਇਹ ਗੇਮ ਨਹੀਂ ਚੱਲਦੀ ਧੰਨਵਾਦ